ਹੈਲੋ ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨਾਂ ਦੀ ਗੱਲ ਹੈ ਕਿ ਮੈਨੂੰ ਕਿਸੇ ਜ਼ਰੂਰੀ ਕੰਮ ਲਈ ਆਪਣੇ ਸ਼ਹਿਰ ਤੋਂ ਦੂਰ ਜਾਣਾ ਪਿਆ ਮੈਂ ਸੋਚਿਆ ਕਿ ਰਸਤਾ ਵੀ ਕਾਫੀ ਹੈ ਕਿਉਂ ਨਾ ਮੈਂ ਕੈਬ ਕਰ ਲਵਾਂ ਮੈਂ ਕੈਬ ਡਰਾਈਵਰ ਨੂੰ ਫੋਨ ਕੀਤਾ ਉਸਨੇ ਮੈਨੂੰ ਅੱਧੇ ਘੰਟੇ ਵਿੱਚ ਪਹੁੰਚਣ ਦਾ ਵਾਅਦਾ ਕੀਤਾ ਮੈਂ ਆਪਣਾ ਐਡਰੈਸ ਉਸਨੂੰ ਸੈਂਡ ਕਰ ਦਿੱਤਾ ਸੀ ਅੱਧੇ ਘੰਟੇ ਬਾਅਦ ਜਦ ਡਰਾਈਵਰ ਨਾ ਆਇਆ ਤਾਂ ਮੈਂ ਦੁਬਾਰਾ ਉਸਨੂੰ ਕਾਲ ਕੀਤੀ ਪਰ ਉਸਨੇ ਮੇਰਾ ਫੋਨ ਨਾ ਚੁੱਕਿਆ ਦੋ ਤਿੰਨ ਵਾਰ ਦੁਬਾਰਾ ਕਾਲ ਕਰਨ 'ਤੇ ਵੀ ਜਦ ਉਸਦੇ ਨਾਲ ਚੁੱਕਿਆ ਤਾਂ ਫਿਰ ਫੋਨ ਚੁੱਕਣ 'ਤੇ ਉਸਨੇ ਮੈਨੂੰ ਕਿਹਾ ਕਿ ਮੈਨੂੰ ਕੋਈ ਜ਼ਰੂਰੀ ਕੰਮ ਹੈ ਮੈਂ ਬਸ ਪੰਦਰ੍ਹਾਂ ਮਿੰਟ ਤੱਕ ਆ ਰਿਹਾ ਹਾਂ ਮੈਨੂੰ ਵੀ ਬਹੁਤ ਜ਼ਰੂਰੀ ਸੀ ਐਮਰਜੰਸੀ ਸੀ ਮੈਂ ਜਾਣਾ ਵੀ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਉਹ ਡਰਾਈਵਰ ਦੀ ਕੈਬ ਰੱਦ ਕਰਕੇ ਕਿਸੇ ਹੋਰ ਕੈਬ ਦਾ ਇੰਤਜ਼ਾਮ ਕੀਤਾ ਅਤੇ ਆਪਣੇ ਸ ਸਥਾਨ 'ਤੇ ਪਹੁੰਚੀ